ਅਸੀਂ ਆਪਣੀ ਪੰਜਾਬੀ ਦੀ ਆਮ ਬੋਲਚਾਲ ਵਿੱਚ ਬਹੁਤ ਸਾਰੀਆਂ ਕਹਾਵਤਾਂ ਮੁਹਾਵਰੇ ਜਿਹੜੇ ਵਰਤਦੇ ਹਾਂ ਜਿਵੇਂ ਆਮ ਤੌਰ 'ਤੇ ਅਸੀਂ ਕਹੀਏ ਪਈ ਜਿਸ ਤਰ੍ਹਾਂ ਕਿਹਾ ਜਾਂਦਾ ਪਈ ਜਿੱਥੇ ਚਾਹ ਉੱਥੇ ਰਾਹ ਯਾਨੀ ਕਿ ਇਸ ਪੰਜਾਬ ਦੇ ਵਿੱਚ ਆਮ ਕਹਾਵਤਾਂ ਬੋਲਚਾਲ ਦੇ ਵਿੱਚ ਅਸੀਂ ਵਰਤਦੇ ਹਾਂ ਇਹਦਾ ਮਤਲਬ ਇਹ ਹੀ ਹੁੰਦਾ ਵੀ ਜੇ ਜੇ ਸਾਡੇ 'ਚ ਕੋਈ ਚਾਹਨਾ ਪੈਦਾ ਕੋਈ ਕੰਮ ਕਰਨ ਦੀ ਚਾਹਨਾ ਪੈਦਾ ਆ ਤਾਂ ਜੇ ਸਾਡੀ ਕਿਸੇ ਕੰਮ ਕਰਨ ਦੀ ਚਾਹਤ ਹੈ ਚਾਹਨਾ ਹੈ ਤਾਂ ਅਸੀਂ ਉਹ ਉਹਦੇ ਲਈ ਰਾਹ ਬਹੁਤ ਸਾਰੇ ਖੁੱਲ ਜਾਂਦੇ ਹੈ ਇਸ ਕਰਕੇ ਪਹਿਲਾਂ ਸਾਡੇ 'ਚ ਕ ਕੋਈ ਵੀ ਕੰਮ ਕਰਨ ਦੀ ਚਾਹਤ ਪੈਦਾ ਹੋਣੀ ਚਾਹੀਦੀ ਹੈ ਤਾਂ ਉਸ ਦੇ ਲਈ ਅੱਗੇ ਰਾਹਤ ਢੰਗ ਤਰੀਕੇ ਆਪਣੇ ਆਪ ਖੁੱਲ੍ਹ ਜਾਂਦੇ ਨੇ ਜਾਂ ਹੋਰ ਤਰ੍ਹਾਂ ਜੇ ਆਪਾਂ ਕਰ ਲਈਏ ਮੁਹਾਵਰੇ ਜਿਸ ਤਰ੍ਹਾਂ ਕਹਿੰਦੇ ਆਪਾਂ ਵੀ ਆਮ ਕਿਹਾ ਜਾਂਦਾ ਪੰਜਾਬ ਦੇ ਵਿੱਚ ਵੀ ਉੱਗਦੀਆਂ ਸੂਲਾਂ ਦੇ ਮੂੰਹ ਤਿੱਖੇ ਉਹਦਾ ਮਤਲਬ ਇਹ ਹੁੰਦਾ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾਂ ਅਤੇ ਇਹ ਇਹ ਪੰਜਾਬ ਦੇ ਲਿਖਾਵਤ ਬਣੀ ਆ ਵੀ ਪੰਜਾਬ ਦੇ ਲੋਕ ਯੋਧੇ ਸੂਰਬੀਰ ਹੁੰਦੇ ਨੇ ਕਿਉਂਕਿ ਇਹ ਸਾਡੇ ਸੱਭਿਆਚਾਰ ਸਾਡੇ ਇਤਿਹਾਸ ਦੇ ਵਿੱਚ ਰਚਿਆ ਹੋਇਆ ਹੈ ਪੰਜਾਬ ਦੀ ਮਿੱਟੀ ਦੇ ਵਿੱਚ ਰਚਿਆ ਹੋਇਆ ਇਸ ਕਰਕੇ ਪੰਜਾਬ ਦੀ ਜਿਹੜੀ ਜਰਖੇਜ਼ ਮਿੱਟੀ ਹੈ ਪੰਜਾਬ ਦਾ ਇਤਿਹਾਸ ਹੈ ਤਾਂ ਇਸ ਕਰਕੇ ਵਰਤਿਆ ਜਾਂਦਾ ਜਿਹੜਾ ਪੰਜਾਬ ਦੇ ਵਿਹੜੇ ਜੰਮਿਆ ਨੂੰ ਨਿੱਤ ਮਹਿਮਾ ਪੰਜਾਬ ਦੇ ਜਿਹੜੇ ਪੰਜਾਬ ਦੇ ਜੰਮਿਆ ਦੇ ਜਿਹੜੇ ਉੱਗਦੀਆਂ ਸੂਲਾਂ ਦੇ ਜਿਹੜੇ ਮੂੰਹ ਉਹ ਤਿੱਖੇ ਹੁੰਦੇ ਹਨ ਅਤੇ ਇਸ ਕਰਕੇ ਹੋਰ ਵੀ ਬਹੁਤ ਸਾਰੀਆਂ ਕਹਾਵਤਾਂ ਵਰਤੀਆਂ ਜਾਂਦੀਆਂ ਜਿਸ ਤਰ੍ਹਾਂ ਕਿਹਾ ਜਾਂਦਾ ਆਪੇ ਫਾਥੜੀਏ ਤੈਨੂੰ ਕੋਣ ਛੜਾਵੇ ਵੀ ਜਿਸ ਨੇ ਜੇ ਤੁਸੀਂ ਆਪ ਪੰਗਾਂ ਖੜ੍ਹਾ ਕੀਤਾ ਅਤੇ ਇਸ ਚ ਕਿਸੇ ਦਾ ਕੋਈ ਕਸੂਰ ਨਹੀਂ ਉਹ ਤੁਹਾਨੂੰ ਆਪ ਹੀ ਹੈਂਡਲ ਕਰਨਾ ਪੈਂਦਾ ਹੈ